ਅੱਜ ਦੇ ਆਧੁਨਿਕ ਸਮੇਂ ਵਿੱਚ ਔਰਤਾਂ ਸੁਰੱਖਿਅਤ ਪੜ੍ਹੀਆਂ ਲਿਖੀਆਂ ਹਨ ਜਦ ਕਿ ਪੁਰਾਣੇ ਸਮਾਜ ਵਿੱਚ ਔਰਤਾਂ ਨੂੰ ਸਿਰਫ਼ ਘਰ ਤੱਕ ਹੀ ਸੀਮਿਤ ਰੱਖਿਆ ਜਾਂਦਾ ਸੀ ਉਹਨਾਂ ਨੂੰ ਸਕੂਲ ਕਾਲਜ ਵਿੱਚ ਜਾਣ ਦੀ ਮਨਾਹੀ ਸੀ ਕਿਉਂਕਿ ਉਹਨਾਂ ਉਨ੍ਹਾਂ ਦਾ ਛੋਟੀ ਉਮਰ ਵਿੱਚ ਵਿਆਹ ਕੀਤਾ ਜਾਂਦਾ ਸੀ ਪਰ ਹੁਣ ਦਾ ਜ਼ਮਾਨਾ ਬਦਲ ਗਿਆ ਹੈ ਹੁਣ ਦੇ ਜ਼ਮਾਨੇ ਵਿੱਚ ਔਰਤਾਂ ਨੂੰ ਪੜ੍ਹਨ ਦਾ ਪੂਰਨ ਅਧਿਕਾਰ ਹੈ ਅਤੇ ਉਹਨਾਂ ਦੀ ਵਿਆਹ ਦੀ ਇੱਕ ਨਿਸ਼ਚਿਤ ਸੀਮਾ ਤੈਅ ਕੀਤੀ ਗਈ ਹੈ ਅਤੇ ਬਾਲ ਮਜ਼ਦੂਰੀ ਬਾਲ ਵਿਵਾਹ ਭਰੂਣ ਹੱਤਿਆ ਆਦਿ ਸਾਰੀ ਬੁਰਾਈਆਂ ਤੋਂ ਔਰਤਾਂ ਦੂਰ ਹਨ ਇਸ ਤੋਂ ਇਲਾਵਾ ਅੱਜ ਅੱਜ ਦੇ ਸਮੇਂ ਵਿੱਚ ਔਰਤਾਂ ਇੰਨਡਿਪੈਨਡਿਡ ਹਨ ਉਹ ਆਪਣਾ ਖ਼ਰਚਾ ਖੁਦ ਚੁੱਕ ਸਕਦੀਆਂ ਹਨ ਕਿਸੇ 'ਤੇ ਭਾਰ ਨਹੀਂ ਬਣਦੀਆਂ ਅਤੇ ਭਾਰਤ ਵਿੱਚ ਔਰਤਾਂ ਬਹੁਤ ਜ਼ਿਆਦਾ ਸੁਰੱਖਿਅਤ ਹਨ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਵੂਮੇ ਵੀਮੇਨ ਸੈੱਲ 'ਤੇ ਬਹੁਤ ਸਾਰੀਆਂ ਕਾਨੂੰਨੀ ਸਹੂਲਤਾਂ ਪ੍ਰਾਪ ਪ੍ਰਦਾਨ ਕੀਤੀਆਂ ਹਨ ਜਿਸ ਦੇ ਨਾਲ਼ ਉਹ ਹਰ ਖੇਤਰ ਹਰ ਜਗ੍ਹਾਂ ਦੇ ਉੱਤੇ ਆਪਣੇ ਆਪ ਨੂੰ ਸੁਰੱਖਿਅਤ ਫ਼ੀਲ ਕਰਦੀਆਂ ਹਨ